ਮੈਂ ਤਾਂ ਕਿਸੇ ਵੀ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਰ ਸਾਡੇ ਮੁਹੱਲੇ ਦੇ ਕੁਝ ਬਜ਼ੁਰਗ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਵੱਲੋਂ ਸਾਨੂੰ ਵੀ ਕੁਝ ਗੱਲਾਂ ਕਰਨ ਤੋਂ ਟੋਕਿਆ ਜਾਂਦਾ ਹੈ ਜਿਵੇਂ ਮੰਜੇ 'ਤੇ ਬੈਠ ਕੇ ਪੈਰ ਹਿਲਾਉਣ ਤੋਂ ਰੋਕਿਆ ਜਾਂਦਾ ਹੈ ਕੈਂਚੀ ਖੜਕਾਉਣ ਤੋਂ ਰੋਕਿਆ ਜਾਂਦਾ ਹੈ ਚਿਮਟਾ ਖੜਕਾਉਣ ਤੋਂ ਰੋਕਿਆ ਜਾਂਦਾ ਹੈ ਚਾਬੀਆਂ ਦਾ ਗੁੱਛਾ ਖੜਕਾਉਣ ਤੋਂ ਰੋਕਿਆ ਜਾਂਦਾ ਹੈ ਜੁੱਤੀਆਂ ਲੈ ਕੇ ਮੰਜੇ 'ਤੇ ਬੈਠਣ ਤੋਂ ਰੋਕਿਆ ਜਾਂਦਾ ਹੈ ਸ਼ਾਮ ਵੇਲੇ ਝਾੜੂ ਮਾਰਨ ਤੋਂ ਰੋਕਿਆ ਜਾਂਦਾ ਹੈ ਸ਼ਾਮ ਵੇਲੇ ਕੰਘੀ ਕਰਨ ਤੋਂ ਰੋਕਿਆ ਜਾਂਦਾ ਹੈ ਨਹੁੰ ਕੱਟਣ ਤੋਂ ਰੋਕਿਆ ਜਾਂਦਾ ਹੈ ਵੀਰਵਾਰ ਵਾਲੇ ਦਿਨ ਸਿਰ ਧੋਣ ਅਤੇ ਕੱਪੜੇ ਧੋਣ ਤੋਂ ਰੋਕਿਆ ਜਾਂਦਾ ਹੈ ਸ਼ਨੀਵਾਰ ਵਾਲੇ ਦਿਨ ਲੋਹਾ ਖਰੀਦਣ ਅਤੇ ਤੇਲ ਖਰੀਦਣ ਤੋਂ ਰੋਕਿਆ ਜਾਂਦਾ ਹੈ ਜੇ ਉਹਨਾਂ ਤੋਂ ਇਸ ਦਾ ਕਾਰਨ ਪੁੱਛਿਆ ਜਾਵੇ ਤਾਂ ਉਹ ਉੱਤਰ ਦਿੰਦੇ ਹਨ ਕਿ ਮੰਜੇ 'ਤੇ ਬੈਠ ਕੇ ਪੈਰ ਹਿਲਾਉਣ ਨਾਲ ਘਰ ਵਿੱਚੋਂ ਬਰਕਤ ਚਲੀ ਜਾਂਦੀ ਹੈ ਕੈਂਚੀ ਖੜਕਾਉਣ ਨਾਲ ਸਮਰੀਧੀ ਚਲੀ ਜਾਂਦੀ ਹੈ ਚਾਬੀ ਅਤੇ ਚਿਮਟਾ ਖੜਕਾਉਣ ਨਾਲ ਘਰ ਵਿੱਚ ਕਲੇਸ਼ ਹੁੰਦੇ ਹਨ ਜੁੱਤੀਆਂ ਲੈ ਕੇ ਮੰਜੇ 'ਤੇ ਬੈਠਣ ਨਾਲ ਘਰ ਵਿੱਚ ਸੱਪ ਆ ਜਾਂਦੇ ਹਨ ਸ਼ਾਮ ਵੇਲੇ ਝਾੜੂ ਮਾਰਨ ਨਾਲ ਲਕਸ਼ਮੀ ਜੀ ਨਾਰਾਜ਼ ਹੋ ਜਾਂਦੇ ਹਨ ਸ਼ਾਮ ਵੇਲੇ ਕੰਘੀ ਕਰਨ ਨਾਲ ਸੁੱਖ ਸ਼ਾਂਤੀ ਖਤਮ ਹੁੰਦੀ ਹੈ ਪਰ ਅਸਲ ਵਿੱਚ ਮੰਜੇ 'ਤੇ ਬੈਠ ਕੇ ਪੈਰ ਹਿਲਾਉਣ ਤੋਂ ਇਸ ਕਰਕੇ ਰੋਕਿਆ ਜਾਂਦਾ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਲੋਕ ਮਿੱਟੀ ਦੇ ਬਰਤਨ ਮੰਜੇ ਥੱਲੇ ਰੱਖਦੇ ਸਨ ਅਤੇ ਪੈਰ ਹਿਲਾਉਂਦੇ ਹਿਲਾਉਂਦੇ ਜੇ ਬਰਤਨਾਂ ਨੂੰ ਲੱਗ ਕੇ ਬਰਤਨ ਟੁੱਟ ਨਾ ਜਾਣ ਇਸ ਕਰਕੇ ਪੈਰ ਹਿਲਾਉਣ ਤੋਂ ਰੋਕਿਆ ਜਾਂਦਾ ਸੀ ਮੰਜੇ 'ਤੇ ਚੱਪਲ ਰੱਖ ਕੇ ਬੈਠਣ ਨਾਲ ਬਿਸਤਰਾ ਗੰਦਾ ਹੋ ਜਾਂਦਾ ਹੈ ਇਸ ਕਰਕੇ ਮੰਜੇ 'ਤੇ ਚੱਪਲਾਂ ਲੈ ਕੇ ਬੈਠਣ ਤੋਂ ਰੋਕਿਆ ਜਾਂਦਾ ਸੀ ਚਾਬੀਆਂ ਖੜਕਾਉਣ ਤੋਂ ਇਸ ਕਰਕੇ ਰੋਕਿਆ ਜਾਂਦਾ ਸੀ ਕਿ ਚਾਬੀਆਂ ਗੁੰਮ ਨਾ ਜਾਣ ਕੈਂਚੀ ਖੜਕਾਉਣ ਨਾਲ ਕੈਂਚੀ ਖਰਾਬ ਹੋ ਜਾਂਦੀ ਸੀ ਸ਼ਾਮ ਵੇਲੇ ਨਹੁੰ ਕੱਟਣ ਤੋਂ ਇਸ ਕਰਕੇ ਰੋਕਿਆ ਜਾਂਦਾ ਸੀ ਕਿ ਚੋਟ ਨਾ ਲੱਗ ਜਾਵੇ ਮੈਂ ਕਿਸੇ ਵੀ ਤਰ੍ਹਾਂ ਦੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਤੇ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਵਹਿਮਾਂ ਭਰਮਾਂ ਦਾ ਖਾਤਮਾ ਹੋਏ ਅਤੇ ਸਮਾਜ ਦਾ ਭਲਾ ਹੋਏ ਅਤੇ ਸਮਾਜ ਉੱਨਤੀ ਕਰੇ